ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਨਾਮ ਪੂਜਾ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਔਰ ਮੇਰਾ ਨਵੀਨ ਇਸਲਾਮਾਬਾਦ ਮੁਹੱਲਾ ਹੈ ਨਵੀਨ ਹੈਲਥ ਕਲੱਬ ਦੇ ਨਜ਼ਦੀਕ ਹੈ ਮੈਂ ਆਪਣੇ ਵਿਆਹ ਦਾ ਆਨੰਦ ਮਾਣਦੇ ਹੋਏ ਮੈਂ ਹੀ ਵਿਆਹ 'ਤੇ ਜਾਣ 'ਤੇ ਫੁੱਲ ਇੰਜੋਇਮੈਂਟ ਹੁੰਦਾ ਹੈ ਬੜਾ ਉਤਸ਼ਾਹ ਹੁੰਦਾ ਹੈ ਅਸੀਂ ਜਿੱਦਾਂ ਬਹੁਤ ਇੰਜੋਇਮੈਂਟ ਕਰਦੇ ਹਾਂ ਮੈਨੂੰ ਵਿਆਹ 'ਚ ਜਿੱਦਾਂ ਪੰਜਾਬੀ ਗਿੱਧਾ ਉਹ 'ਚ ਉਹ 'ਚ ਨੱਚਣ ਦਾ ਬਹੁਤ ਸ਼ੌਕ ਹੈ ਅਤੇ ਮਾਪੀ ਪੰਜਾਬੀ ਬੋਲੀਆਂ ਜੈਸੇ ਅੱਜ ਕੱਲ੍ਹ ਲੇਡੀ ਸੰਗੀਤ 'ਚ ਪੰਜਾਬੀ ਬੋਲੀਆਂ 'ਚ ਨੱਚਣਾ ਅਤੇ ਇੰਜੋਏ ਕਰਨਾ ਕਾਫੀ ਅੱਛਾ ਲੱਗਦਾ ਹੈ ਹਾਂਜੀ ਹਾਂਜੀ ਜੀ ਮੈਨੂੰ ਬੋਲੀਆਂ ਪੰਜਾਬੀ ਭੰਗੜੇ ਪੰਜਾਬੀ ਸੌਂਗ ਅਤੇ ਟਾਸਕ ਨਾਲ ਭੰਗੜਾ ਪਾਉਣਾ ਬਹੁਤ ਵਧੀਆ ਲੱਗਦਾ ਇੰਜੋਏ ਕਾਫੀ ਇੰਜੋਏ ਹੁੰਦਾ ਹੈ ਲੇਡੀ ਸੰਗੀਤ 'ਚ ਸ਼ਗੁਨ 'ਤੇ ਪੰਜਾਬੀ ਸੌਂਗ ਜਿਹੜੇ ਭੰਗੜਾ ਪਾਉਣਾ ਉਹ ਕਾਫੀ ਮਸ਼ਹੂਰ ਹੈ ਅਸੀਂ ਮੈਂ ਖੁਦ ਆਪਣੀ ਮੈਰਿਜ 'ਤੇ ਵੀ ਕਾਫੀ ਇੰਜੋਏ ਕੀਤਾ ਹਰ ਪੰਜਾਬੀ ਸੌਂਗ ਸੀ ਬੋਲੀਆਂ ਛੇ ਕਾਫੀ ਮਤਲਬ ਨੱਚੀ ਔਰ ਨੱਚੇ ਨੱਚਣ ਦਾ ਆਨੰਦ ਮਾਣਿਆ ਪੰਜਾਬੀ ਬੋਲੀਆਂ 'ਚ ਕਾਫੀ ਮੈਂ ਨੱਚੀ ਹਾਂ ਔਰ ਮੇਰੇ ਬ੍ਰਦਰ ਦੀ ਮੈਰਿਜ 'ਤੇ ਕਾਫੀ ਇੰਜੋਏਮੈਂਟ ਕੀਤਾ ਪੰਜਾਬੀ ਬੋਲੀਆਂ 'ਤੇ ਉਹ ਬੋਲੀਆਂ ਪਾ ਕੇ ਖੂਬ ਖੂਬ ਨੱਚੇ ਟੱਪੇ ਔਰ ਕਾਫੀ ਚਾਅ ਅਤੇ ਕਜ਼ਨ ਸਿਸਟਰ ਸਾਰੇ ਇਕੱਠੇ ਹੋ ਕੇ ਕਾਫੀ ਇੰਜੋਏ ਕੀਤਾ ਹਰ ਗਾਣੇ 'ਤੇ ਡਾਂਸ ਬੋਲੀ 'ਤੇ ਡਾਂਸ ਜਾਗੋ ਕੱਢਣ ਵੇਲੇ ਪੰਜਾਬੀ ਬੋਲੀਆਂ ਪਾਉਣੀਆਂ ਉੱਥੇ ਨੱਚਣਾ ਗਿੱਧਾ ਪਾਉਣਾ ਉਹ ਕਾਫੀ ਪ੍ਰਾਏਟੀ ਹਰ ਰਿਸ਼ਤੇਦਾਰ ਇਕੱਠੇ ਹੁੰਦੇ ਹਾਂ ਜਿਸ ਸੇ ਹਰ ਮਾਪੀ ਹਰ ਬੋਲੀ 'ਚ ਹਰ ਬੋਲੀ 'ਚ ਨੱਚਣਾ ਕਾਫੀ ਇੰਜੋਇਮੈਂਟ ਹੁੰਦੀ ਹੈ ਵੱਡੀ ਔਰ ਬ੍ਰਦਰ ਨਾਲ ਡਾਂਸ ਕਰਨਾ ਬਹੁਤ ਅੱਛਾ ਲੱਗਦਾ ਮੈਨੂੰ ਹੂੰ ਔਰ ਉਸ ਤਾਨੇ ਦੀ ਨਨਾਣ ਦੀ ਮੈਰਿਜ ਹੋਈ ਉੱਥੇ ਗਈ ਕਾਫੀ ਇੰਜੋਇਮੈਂਟ ਕੀਤਾ ਕਾਫੀ ਮਾਪੀ ਸੱਤ ਦਿਨ ਦਾ ਲੇਡੀਸ ਸੰਗੀਤ ਰੱਖਿਆ ਹੋਇਆ ਸੀ ਸੱਤ ਦਿਨ ਇੰਜੋਏ ਕੀਤਾ ਪੰਜਾਬੀ ਬੋਲੀਆਂ 'ਚ ਪੰਜਾਬੀ ਭੰਗੜੇ 'ਚ ਅਤੇ ਕਾਫੀ ਇੰਜੋਇਮੈਂਟ ਵੀ ਸਾਨੂੰ ਅਤੇ ਕਾਫੀ ਨੱਚੇ ਅਸੀਂ ਟੱਪੇ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਮਾਣਦੇ ਹਾਂ ਵਿਆਹ ਸ਼ਾਦੀ 'ਚ ਹੀ